ਸ਼ੋਸ਼ਲ ਮੀਡੀਆ 'ਤੇ ਅਸੀਂ ਕਿਸ ਤਰ੍ਹਾਂ ਦੀ ਸਮੱਗਰੀ ਪਾਉਂਦਾ ਹਾਂ ਸਾਨੂੰ ਵਧੀਆ ਹੀ ਹੋਣੀ ਚਾਹੀਦੀ ਹੈ ਸਮੱਗਰੀ ਤਾਂ ਸਾਡੇ ਕੋਲ ਬਹੁਤ ਤਰ੍ਹਾਂ ਦੀ ਹੁੰਦੀ ਆ ਅਗਰ ਅਸੀਂ ਬਹੁਤ ਵਧੀਆ ਪਾਵਾਂਗੇ ਤਾਂ ਸਾਨੂੰ ਦੁਨੀਆਂਦਾਰੀ ਵਿੱਚ ਵਿਚਰਦੇ ਸਮੇਂ ਸਭ ਦੀਆਂ ਅੱਖਾਂ ਵਿੱਚ ਅਸੀਂ ਚੰਗੇ ਦਿਖਾਂਗੇ ਅਗਰ ਅਸੀਂ ਗਲਤ ਸਮੱਗਰੀ ਪਾਵਾਂਗੇ ਤਾਂ ਸਾਨੂੰ ਦੁਨੀਆਂਦਾਰੀ ਵਿੱਚ ਵਿਚਰਦੇ ਸਮੇਂ ਬਹੁਤ ਗੰਦੇ ਕਮੈਂਟ ਵੀ ਸੁਣਨੇ ਪੈਣਗੇ ਇਸ ਤਰ੍ਹਾਂ ਜੋ ਵੀ ਅਸੀਂ ਕਰਾਂਗੇ ਉਹ ਵਧੀਆ ਕਰੋ ਠੀਕ ਹੈ ਦੇਖਣ ਵਾਲੇ ਨੂੰ ਤਾਂ ਸੁਣਨ ਵਾਲੇ ਨੂੰ ਵੀ ਸਾਡੇ ਪ੍ਰਤੀ ਚੰਗੇ ਵਿਚਾਰ ਪੇਸ਼ ਕਰਨ ਅਤੇ ਅਸੀਂ ਉਹਨਾਂ ਦੀ ਨਿਗ੍ਹਾ ਵਿੱਚ ਚੰਗੇ ਹੋਈਏ ਅਗਰ ਅਸੀਂ ਕਦੇ ਕਿਸੇ ਦੀ ਨਿੱਝਤਾ ਤੋਂ ਡਰਦੇ ਹਾਂ ਅਸੀਂ ਡਰਦੇ ਇਸ ਕਰਕੇ ਹਾਂ ਕਿ ਅਸੀਂ ਜੋ ਗਲਤ ਕੀਤਾ ਹੈ ਤੇ ਸਾਨੂੰ ਗਲਤ ਹੀ ਸੁਣਨਾ ਪੈਣਾ ਗਲਤ ਹੀ ਸਾਨੂੰ ਸਹਿਣਾ ਪੈਣਾ ਪਰ ਸਹਿਣ ਦੀ ਸ਼ਮਤਾ ਸਾਡੇ ਵਿੱਚ ਗਲਤ ਨਹੀਂ ਹੁੰਦੀ ਠੀਕ ਹੈ ਜੀ ਇਸ ਕਰਕੇ ਅਸੀਂ ਜੋ ਕਰੀਏ ਉਸਨੂੰ ਵਧੀਆ ਹੀ ਕਰੀਏ ਜਿਵੇਂ ਕਿ ਅਸੀਂ ਸੋਸ਼ਲ ਮੀਡੀਆ 'ਤੇ ਕੋਈ ਗਾਣਾ ਵਧੀਆ ਗਾਣਾ ਗਾ ਕੇ ਉਹ ਦੱਸ ਸਕਦੇ ਹਾਂ ਕੋਈ ਬੋਲੀਆਂ ਪਾ ਸਕਦੇ ਹਾਂ ਕੋਈ ਗੁਰਦੁਆਰਾ ਸਾਹਿਬ ਜਾਓ ਉੱਥੇ ਜੋ ਸਾਨੂੰ ਚੰਗਾ ਲੱਗੇ ਉਹ ਅਸੀਂ ਆਪਣੇ ਵਿਚਾਰ ਪੇਸ਼ ਕਰ ਸਕਦੇ ਹਾਂ ਅਤੇ ਧੰਨਵਾਦ